ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਬੋਂਬੇ ਢਾਬੇ ਤੋਂ ਬੋਲਣ ਡੇ ਭਾਅ ਜੀ ਆਰਡਰ ਕਰਨਾ ਸੀ ਦੋ ਬਟਰ ਨਾਨ ਤਿੰਨ ਬਟਰ ਚਿਕਨ ਦਸ ਬਟਰ ਰੋਟੀਆਂ ਵੀਹ ਪਰਾਂਠੇ ਹਾਂਜੀ ਅਤੇ ਇਹ ਨਾ ਬ੍ਰਹਮਪੁਰ ਰੋਡ 'ਤੇ ਤੁਸੀਂ ਦੇ ਦਿਓ ਟੈਗੋਰ ਸਕੂਲ ਲਾਗੇ ਹਾਂਜੀ ਹਾਂਜੀ ਅਤੇ ਆਪਣੇ ਕੋਲ ਮਿੱਠੇ ਵਿੱਚ ਕੀ ਆ ਅੱਛਾ ਆਈਸਕਰੀਮ ਹੈ ਲੱਸੀ ਹੈ ਕੋਲਡਰਿੰਕ ਹੈ ਅਤੇ ਜੇ ਸਭ ਕੁਛ ਲੈਣ ਹੋਵੇ ਕਿੰਨੇ ਦਾ ਪਵੇਗਾ ਅੱਛਾ ਮਤਲਬ ਕਿ ਇੱਕ ਨਾਲ ਇੱਕ ਫ੍ਰੀ ਹੈ ਠੀਕ ਆ ਅੱਛਾ ਮਤਲਬ ਕਿ ਇਹ ਦਸ ਬਟਰ ਨਾਨ ਹੋਰ ਲਵਾਂਗਾ ਤਾਂ ਉਹਨਾਂ ਨਾਲ ਦੋ ਫ੍ਰੀ ਮਿਲਣਗੇ ਠੀਕ ਹੈ ਠੀਕ ਹੈ ਅਤੇ ਫਿਰ ਇੱਦਾਂ ਕਰੋ ਦਸ ਬਟਰ ਨਾਨ ਕਰ ਦਿਓ ਅਤੇ ਵੀਹ ਰੋਟੀਆਂ ਕਰ ਦਿਓ ਫਿਰ ਅਤੇ ਕਿੰਨੇ ਕੁ ਟਾਈਮ ਤੱਕ ਆਜੂ ਉਹ ਘਰ ਪ੍ਰਾਹੁਣੇ ਆਏ ਵੇ ਹੈ ਅੱਛਾ ਅੱਛਾ ਮਾੜਾ ਜਾ ਛੇਤੀ ਕਰ ਦਿਓ ਕਿ ਚਲ ਨਾ ਜਾਣ ਕਿਤੇ ਐਵੇਂ ਹੀ ਤੁਹਾਨੂੰ ਪਤਾ ਹੀ ਹੈ ਫਿਰ ਅੱਗੇ ਮੂੰਹ ਬਣਾ ਕੇ ਆਏ ਹੁੰਦੇ ਆ ਹਾਂ ਠੀਕ ਹੈ ਠੀਕ ਹੈ ਅਤੇ ਬਾਕੀ ਪਾਪੜ ਪੁਪੜ ਹੋਵੇਗਾ ਨਾਲ ਕੋਈ ਠੀਕ ਆ ਠੀਕ ਆ ਪਾਪੜ ਪਾ ਦਿਓ ਅਤੇ ਸਲਾਦ ਜ਼ਰੂਰ ਪਾਇਓ ਭਾਅ ਜੀ ਹਾਂਜੀ ਹਾਂਜੀ ਕਿੰਨਾ ਕੁ ਸਲਾਦ ਮਿਲਜੂਗਾ ਅੱਛਾ ਇੱਕ ਕੋਲੀ ਦੋ ਕਰ ਦਿਓ ਹੈਂ ਅਤੇ ਪੇਮੈਂਟ ਔਨਲਾਈਨ ਲੈਂਦੇ ਹੋ ਜਾਂ ਕੈਸ਼ ਕੈਸ਼ ਠੀਕ ਹੈ ਠੀਕ ਹੈ ਅਤੇ ਇੱਕ ਕੰਮ ਕਰਿਓ ਉਦੋਂ ਫਿਰ ਕਿੰਨਾ ਹੋਇਆ ਮੈਨੂੰ ਪੂਰਾ ਦੱਸ ਦਿਓ ਕਿੰਨਾ ਬਣਿਆ ਹਜ਼ਾਰ ਡਿਸਕਾਊਂਟ ਯਾਰ ਲਾਓ ਕੁਛ ਪਹਿਲੀ ਵਾਰੀ ਮੰਗਾਨ ਡਏ ਅੱਗੋਂ ਮਗਾਵਾਂਵਾਗੇ ਸਵਾਦ ਲੱਗੇਗਾ ਤਾਂ ਠੀਕ ਹੈ ਠੀਕ ਹੈ ਠੀਕ ਹੈ ਚੱਲੋ ਅੱਠ ਸੌ ਰੱਖ ਹਾਂ ਅੱਠ ਸੌ ਠੀਕ ਆ ਫਿਰ ਠੀਕ ਆ ਜਦੋਂ ਡਿਲੀਵਰੀ ਪਾਰਟਨਰ ਜਦੋਂ ਆਵੇਗਾ ਉਹਨੂੰ ਅੱਠ ਸੌ ਰੁਪਈਆ ਫੜਾ ਦਾਂਗੇ ਚੱਲੋ ਠੀਕ ਹੈ ਠੀਕ ਹੈ ਥੈਂਕ ਯੂ ਭਾਅ ਜੀ ਮਿਹਰਬਾਨੀ ਮਿਹਰਬਾਨੀ ਓਕੇ ਭਾਅ ਜੀ